ਊਧਮ ਸਿੰਘ ਜੀ ਭਾਵ ਊਧਮ ਸਿੰਘ ਜੀ ਇੱਕ ਬਹੁਤ ਹੀ ਹੋਣਹਾਰ ਨੌਜਵਾਨ ਸਨ ਜੋ ਕਿ ਹਰੇਕ ਮਤਲਬ ਅੱਜ ਕੱਲ੍ਹ ਦੇ ਨੌਜਵਾਨ ਮਤਲਬ ਪੁਰਾਣੇ ਨੌਜਵਾਨ ਸਾਰੇ ਉਹਨਾਂ ਨੂੰ ਜਾਣਦੇ ਸਨ ਬਹੁਤ ਹੀ ਚੰਗੀ ਤਰ੍ਹਾਂ ਅਤੇ ਅੱਜ ਬੱਚਾ ਬੱਚਾ ਵੀ ਜਾਣਦਾ ਇਹ ਆਮ ਤੌਰ 'ਤੇ ਸਾਡੇ ਹਿਸਟਰੀ ਅਤੇ ਪੰਜਾਬੀ ਵਿੱਚ ਹੀ ਊਧਮ ਸਿੰਘ ਬਾਰੇ ਦੱਸਿਆ ਜਾਂਦਾ ਨਾ ਕਿ ਅੰਗਰੇਜ਼ੀ ਵਿੱਚ ਵੀ ਸਾਰੇ ਹੀ ਵਿਸ਼ਿਆਂ ਵਿਚ ਸਾਨੂੰ ਊਧਮ ਸਿੰਘ ਜੀ ਬਾਰੇ ਪੜ੍ਹਾਇਆ ਜਾਂਦਾ ਹੈ ਅਤੇ ਊਧਮ ਸਿੰਘ ਜੀ ਨੇ ਸਾਨੂੰ ਸੋ ਸਾਡੇ ਪੰਜਾਬ ਸਾਨੂੰ ਅ ਪੰਜਾਬ ਤੋਂ ਮਤਲਬ ਅੰਗਰੇਜ਼ਾਂ ਨੂੰ ਮੁਕਤ ਕਰਵਾਇਆ ਅਤੇ ਜੋ ਕਿ ਹੈ ਨਾ ਅੰਗਰੇਜ਼ ਅਧਿਕਾਰੀ ਸਾਨੂੰ ਓ ਕੀ ਉਹ ਸਾਡੇ ਪੰਜਾਬ 'ਤੇ ਮਤਲਬ ਕਬਜਾ ਕਰਨਾ ਚਾਹੁੰਦੇ ਸਨ ਅਤੇ ਜ ਜਲ੍ਹਿਆਂਵਾਲੇ ਬਾਗ ਵਿਚ ਅੰਗਰੇਜ਼ਾਂ ਨੇ ਮਤਲਬ ਕਬਜਾ ਕੀਤਾ ਸੀ ਅਤੇ ਉੱਥੇ ਹੀ ਗੋਲੀਆਂ ਨਾਲ ਮਤਲਬ ਪੰਜਾਬੀਆਂ ਨੂੰ ਭੁੰਨ ਦਿੱਤਾ ਸੀ ਜੋ ਕਿ ਅ ਜਿਸ ਕਾਰਨ ਹਨਾ ਮਤਲਬ ਅੰਗਰੇਜ਼ ਪੰਜਾਬੀ ਅਧਿਕਾਰਾਂ ਨੂੰ ਬਹੁਤ ਗੁੱਸਾ ਚੜਿਆ ਸੀ ਅਤੇ ਉਸ ਉਸ ਕਾਰਨ ਉਹ ਸਾਨੂੰ ਮਤਲਬ ਊਧਮ ਸਿੰਘ ਜੀ ਨੇ ਮਤਲਬ ਅੰਗਰੇਜ਼ਾਂ ਤੋਂ ਪੰਜਾਬ ਨੂੰ ਮੁਕਤ ਕਰਵਾ ਦਿੱਤਾ ਸੀ ਅਤੇ ਉਸ ਸਮੇਂ ਅ ਮਤਲਬ ਲੰ ਅਰ ਮਾਈਕਲ ਐਡਵਾਈਡ ਦੀ ਹੱਤਿਆ ਮਤਲਬ ਭਾਵ ਹੱਤਿਆ ਉਸਦੀ ਉੱਥੇ ਹੋਈ ਬਾਹਰ ਜਾ ਕੇ ਉਹਨੀ ਅੰਗਰੇਜ਼ਾਂ ਦੇ ਘਰ ਭੁੰਨ ਦਿੱਤਾ ਇਸ ਕਾਰਨ ਪੰਜਾਬੀ ਮਤਲਬ ਲੋਕ ਮਤਲਬ ਸਭਿ ਸੱਭਿਆਚਾਰ ਕਈ ਤਰ੍ਹਾਂ ਦੇ ਕਿੱਤਿਆਂ ਵਿੱਚ ਕਰ ਦਿੰਦੇ ਸਨ ਅਸੀਂ ਇਹ ਚਾਹੁੰਦੇ ਹਾਂ ਕੀ ਮਤਲਬ ਜਿਹੜੇ ਲੋਕ ਸੀਗੇ ਪੁਰਾਣੇ ਜਮਾਨੇ ਵਿਚ ਉਹ ਹਨਾ ਬਦਲੇ ਦੀ ਭਾਵਨਾ ਵਿਚ ਇੱਕਜੁਟ ਰਹਿੰਦੇ ਹੋਏ ਸਨ ਇਸ ਲਈ ਸਾਨੂੰ ਇਸ ਲਈ ਸਾਡੇ ਸਾਨੂੰ ਸਮਾਜ ਵਿੱਚ ਦੱਸਿਆ ਜਾਂਦਾ ਹੈ ਕਿ ਪ ਅੰਗਰੇਜ਼ੀ ਮਾ ਅੰਗਰੇਜ਼ਾਂ ਦੇ ਵਿਰੁੱਧ ਅਸੀਂ ਲੜ ਸਕਦੇ ਹਾਂ ਅਤੇ ਸ ਉਹ ਲੜਨ ਦੀ ਸਾਡੇ ਸਮਾਜ ਵਿੱਚ ਪ ਬਹੁਤ ਹੀ ਭਾਵਨਾ ਜਾਗਦੀ ਅੱਜ ਕੱਲ੍ਹ ਦੇ ਯੁੱਗ ਅ ਲੋਕ ਮਤਲਬ ਊਧਮ ਸਿੰਘ ਜੀ ਟਰੱਸਟ ਹੁੰਦੇ ਆ ਮਤਲਬ ਊਧਮ ਸਿੰਘ ਜੀ ਦਾ ਪ ਮਤਲਬ ਨਾਮ ਬਹੁਤ ਹੀ ਮਸ਼ਹੂਰ ਚੱਲ ਰਿਹਾ ਹੈ ਅਤੇ ਸੰਸਸ ਪੰਜਾਬ ਦੀ ਸੰਸਕ੍ਰਿਤੀ ਬਾਰੇ ਗੱਲਾਂ ਕਰਦੇ ਹਨ ਅਤੇ ਇਸ ਲਈ ਸਾਡੇ ਸਮਾਜ ਵਿੱਚ ਪੰਜਾਬੀਆਂ ਨੂੰ ਬੜਾ ਮਾਣ ਮਹਿਸੂਸ ਹੁੰਦਾ ਹੈ ਕਿ ਅਸੀਂ ਅੰਗਰੇਜ਼ਾਂ ਤੋਂ ਭਾਰਤ ਨੂੰ ਮੁਕਤ ਕਰਵਾ ਸਕਦੇ ਹਾਂ